ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਪਣੇ ਘਰ ਘਰੋਂ ਕੰਮ ਨੂੰ ਜਾਣ ਲਈ ਤੁਹਾਡੀ ਕੈਬ ਬੁੱਕ ਕਰਵਾਈ ਸੀ ਅਤੇ ਐਪ 'ਤੇ ਤੁਹਾਡਾ ਜਿਹੜਾ ਰੇਟ ਸੀਗਾ ਕੈਬ ਦਾ ਉਹ ਸੱਤ ਸੌ ਰੁਪਏ ਸੀਗਾ ਲੇਕਿਨ ਡਰਾਈਵਰ ਮੇਰੇ ਤੋਂ ਨੌ ਸੌ ਰੁਪਏ ਮੰਗ ਰਿਹਾ ਸੀਗਾ ਇਹ ਗੱਲ ਮੈਨੂੰ ਬੜੀ ਗਲਤ ਲੱਗੀ ਉਹਨੇ ਮੇਰੇ ਤੋਂ ਦੋ ਸੌ ਰੁਪਏ ਵੱਧ ਮੰਗੇ ਅਤੇ ਮੈਂ ਇਹੀ ਤੁਹਾਡੇ ਤੋਂ ਸ਼ਿਕਾਇਤ ਕਰਨਾ ਚਾਹੁੰਦਾ ਹੈ ਕਿ ਉਹ ਦੋ ਸੌ ਰੁਪਏ ਕਿਸ ਗੱਲ ਦੇ ਮੰਗ ਰਿਹਾ ਸੀਗਾ ਇਹ ਤਾਂ ਬਾਈ ਕਸਟਮਰਾਂ ਨੂੰ ਲੁੱਟਣ ਵਾਲੀ ਗੱਲ ਹੋ ਗਈ ਮੈਂ ਤੁਹਾਡੇ ਤੋਂ ਕਿਰਪਾ ਕਰਕੇ ਕਹਿੰਦਾ ਕਿ ਇਹ ਬਾਰੇ ਦੇਖਿਆ ਜਾਵੇ ਅਤੇ ਡਰਾਈਵਰ ਦੇ ਅਗੇਂਸਟ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ